ਹੈਲੋ ਮੇਰਾ ਨਾਮ ਗੁਰ ਪ੍ਰਤਾਪ ਸਿੰਘ ਹੈ ਅਤੇ ਅੱਜ ਮੈਂ ਆਪਣਾ ਟੋਪਿਕ ਪੰਜਾਬ ਦੇ ਬਜ਼ਾਰਾਂ ਬਾਰੇ ਬੋਲਣ ਜਾ ਰਿਹਾ ਹਾਂ ਜਿਵੇਂ ਕਿ ਸਾਰਿਆਂ ਸਾਰੇ ਪੰਜਾਬ 'ਚੋਂ ਪਹਿਲਾਂ ਅੰਮ੍ਰਿਤਸਰ ਦਾ ਗੁਰੂ ਕੀ ਨਗਰੀ ਬਜ਼ਾਰ ਬਹੁਤ ਹੀ ਜ਼ਿਆਦਾ ਮਸ਼ਹੂਰ ਬਜ਼ਾਰ ਹੈ ਅਤੇ ਜਿੱਥੇ ਕਿ ਸਾਨੂੰ ਬਹੁਤ ਹੀ ਜ਼ਿਆਦਾ ਸਿੱਖਿਆ ਮਿਲਦੀ ਹੈ ਅਤੇ ਸਾਡੇ ਸਿੱਖ ਧਰਮ ਵਿੱਚ ਗੁਰੂ ਕੀ ਨਗਰੀ ਇਤਿਹਾਸ ਰਚਿਆ ਗਿਆ ਹੈ ਅਤੇ ਇਸ ਇਤਿਹਾਸ ਵਿੱਚ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਰਾਮਦਾਸ ਜੀ ਬਾਰੇ ਬਹੁਤ ਜਾਣਕਾਰੀ ਦਿੱਤੀ ਗਈ ਹੈ ਅਤੇ ਅੰਮ੍ਰਿਤਸਰ ਦਾ ਗੁਰੂ ਕੀ ਨਗਰੀ ਬਜ਼ਾਰ ਵਿੱਚ ਲੋਕ ਬਹੁਤ ਹੀ ਜ਼ਿਆਦਾ ਜਾਂਦੇ ਹਨ ਅਤੇ ਮੈਂ ਮਹੀਨੇ ਵਿੱਚ ਜਾਂ ਦੋ ਮਹੀਨਿਆਂ ਵਿੱਚ ਇੱਕ ਵਾਰ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਜਾਂਦਾ ਹੀ ਰਹਿੰਦਾ ਹਾਂ ਕਿਉਂਕਿ ਉੱਥੇ ਜਾ ਕੇ ਮੈਨੂੰ ਬਹੁਤ ਹੀ ਜ਼ਿਆਦਾ ਸਿੱਖਿਆ ਮਿਲਦੀ ਹੈ ਅਤੇ ਉੱਥੇ ਪੰਜਾਬ ਦੇ ਸਾਰੇ ਹੀ ਲੋਕ ਜਾਂਦੇ ਹਨ ਦੇਖਣ ਅਤੇ ਉੱਥੇ ਉੱਥੋਂ ਦਾ ਗੋਲਡਨ ਟੈਂਪਲ ਬਹੁਤ ਮਸ਼ਹੂਰ ਹੈ ਜਿਵੇਂ ਕਿ ਬਾਹਰਲੇ ਦੇਸ਼ਾਂ ਵਿੱਚੋਂ ਵੀ ਲੋਕ ਉੱਥੇ ਘੁੰਮਣ ਆਉਂਦੇ ਹਨ ਅਤੇ ਇੱਥੋਂ ਦੇ ਬਠਿੰਡਾ ਬਜ਼ਾਰ ਦਾ ਸਰਕੀ ਬਜ਼ਾਰ ਅਤੇ ਬੈਂਕ ਬਜ਼ਾਰ ਬਹੁਤ ਮਸ਼ਹੂਰ ਹੈ ਬੈਂਕ ਬਜ਼ਾਰ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਮੁਨਾਫਾ ਹੁੰਦਾ ਹੈ ਅਤੇ ਸਰਕੀ ਬਜ਼ਾਰ ਵਿੱਚ ਬੱਚਿਆਂ ਦੇ ਖਿਡੌਣੇ ਜਾਂ ਕੋਈ ਅਜਿਹੀਆਂ ਚੀਜ਼ਾਂ ਮਿਲਦੀਆਂ ਹਨ ਕਿ ਜਿਸ ਨਾਲ ਸਾਨੂੰ ਬਹੁਤ ਹੀ ਨੇੜੇ ਕਾਰਨ ਬਹੁਤ ਹੀ ਫਾਇਦਾ ਹੁੰਦਾ ਹੈ ਅਤੇ ਗਿੱਦੜਵੇ ਦਾ ਮਸ਼ਹੂਰ ਗੁੜ ਬਜ਼ਾਰ ਹੈ ਜਿੱਥੇ ਕਿ ਗੰਨੇ ਤੋਂ ਗੁੜ ਤਿਆਰ ਕੀਤਾ ਜਾਂਦਾ ਹੈ ਅਤੇ ਗੰਨੇ ਤੋਂ ਵੀ ਖੰਡ ਵੀ ਤਿਆਰ ਕੀਤੀ ਜਾਂਦੀ ਹੈ ਅਤੇ ਗਿੱਦੜਵੇ ਮਸ਼ਹੂਰ ਹੀ ਬਹੁਤ ਹੀ ਜ਼ਿਆਦਾ ਮਸ਼ਹੂਰ ਬਜ਼ਾਰ ਹੈ ਕਿਉਂਕਿ ਇੱਥੇ ਨਾ ਬਾਹਲਾ ਅੱਧੇ ਪੰਜਾਬ ਵਿੱਚ ਗੰਨੇ ਦਾ ਹੀ ਗੁੜ ਅਤੇ ਗੰਨੇ ਦੀ ਖੰਡ ਜਾਂਦੀ ਹੈ ਜਿਸ ਨਾਲ ਜਿਸ ਜੋ ਕਿ ਲੋਕਾਂ ਨੂੰ ਗੁੜ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਅਤੇ ਉਸ ਨਾਲ ਪੇਟ ਬਹੁਤ ਵਧੀਆ ਰਹਿੰਦਾ ਹੈ ਗੁੜ ਨਾਲ ਤਾਂ ਕਰਕੇ ਗਿੱਦੜਵੇ ਦਾ ਗੁੜ ਬਜ਼ਾਰ ਬਹੁਤ ਮਸ਼ਹੂਰ ਹੈ ਇਸ ਲਈ ਲੋਕ ਇਸ ਇਸ ਨਾਮ ਨਾਲ ਹੀ ਪੰਜਾਬ ਦੇ ਬਜ਼ਾਰ ਜਾਣੇ ਜਾਂਦੇ ਹਨ ਅਤੇ ਇਹ ਖਾਸੀਅਤ ਹੈ ਪੰਜਾਬ ਦੇ ਬਜ਼ਾਰਾਂ ਦੀ ਕਿ ਇਸ ਨਾਲ ਹੀ ਪੰਜਾਬ ਦੇ ਬਜ਼ਾਰ ਬਹੁਤ ਹੀ ਜ਼ਿਆਦਾ ਵਧੀਆ ਅਤੇ ਬਾਹਰਲੇ ਦੇਸ਼ਾਂ ਤੱਕ ਇਹ ਬਜ਼ਾਰ ਬਾਹਰਲੇ ਦੇਸ਼ਾਂ ਤੱਕ ਦੇ ਵੀ ਲੋਕ ਇੱਥੇ ਬਜ਼ਾਰਾਂ ਵਿੱਚ ਆਉਂਦੇ ਹਨ ਅਤੇ ਉਹਨਾਂ ਨੂੰ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ ਜਿਵੇਂ ਕਿ ਉਹ ਆਪਣੇ ਪੰਜਾਬ ਦੇ ਬਜ਼ਾਰਾਂ ਦੀ ਵੀਡੀਓ ਹੋਰ ਦੇਸ਼ਾਂ 'ਚ ਸੈਂਡ ਕਰਦੇ ਹਨ ਅਤੇ ਬਾਹਰ ਆਪਣੇ ਦੋਸਤਾਂ ਫਰੈਂਡ ਮਿੱਤਰਾਂ ਨੂੰ ਦਿਖਾਉਂਦੇ ਹਨ ਇਸ ਲਈ ਮੈਂ ਪੰਜਾਬ ਦੇ ਬਜ਼ਾਰਾਂ ਬਾਰੇ ਦੱਸਣ ਤੋਂ ਬਾਅਦ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ